ਮੇਰੀ ਸਥਾਨਕ ਭਾਸ਼ਾ ਪੰਜਾਬੀ ਵਿੱਚ ਬਹੁਤ ਨਿਊਜ਼ ਚੈਨਲ ਹਨ ਜਿਵੇਂ ਜੀ ਪੰਜਾਬੀ ਪੀਟੀਸੀ ਨਿਊਜ਼ ਚੜਦੀ ਕਲਾ ਨਿਊਜ ਚੈਨਲ ਐਮ ਐਚ ਵਨ ਨਿਊਜ਼ ਅਤੇ ਸਰਕਾਰੀ ਚੈਨਲ ਡੀ ਡੀ ਪੰਜਾਬੀ ਹਾਂ ਲੋਕ ਆਪਣੇ ਮੂਲ ਭਾਸ਼ਾ ਵਿੱਚ ਖਬਰਾਂ ਦੇਖਣਾ ਪਸੰਦ ਕਰਦੇ ਹਨ ਕਿਉਂਕਿ ਇਹ ਇੱਕ ਅਨਪੜ ਵਿਅਕਤੀ ਵੀ ਸਮਝ ਸਕਦਾ ਹੈ